ਬੱਚਿਆਂ ਨੂੰ ਸਕੂਲ ਦੇ ਵਿੱਚ ਕੋਕਰੀਕੁਲਰ ਐਕਟੀਵਿਟੀਸ ਦੀ ਫੋਮ ਦੇ ਵਿੱਚ ਜੋ ਹੈ ਉਹ ਹੈਂਡੀਕ੍ਰਾਫਟਸ ਬਾਰੇ ਗਿਆਨ ਦੇਣਾ ਚਾਹੀਦਾ ਹੈ ਇਸ ਨਾਲ ਬੱਚਿਆਂ ਦੀ ਨੌਲੇਜ ਵੀ ਵਧੇਗੀ ਬੱਚਿਆਂ ਦੇ ਵਿੱਚ ਇੱਕ ਨਵੀਂ ਜੋ ਹੈ ਉਹ ਕਲਾ ਵੀ ਆਏਗੀ ਅਤੇ ਹੈਂਡੀਕ੍ਰਾਫਟ ਇੰਡਸਟਰੀ ਜੋ ਹੈ ਉਸਦੇ ਵਿੱਚ ਵੀ ਅੱਗੇ ਜਾ ਕੇ ਕਰੀਅਰ ਬਣਾ ਸਕਦਾ ਏ ਇੱਕ ਬੱਚਾ ਮੋਰਓਵਰ ਇਹਦੇ ਵਿੱਚ ਜੋ ਹੈ ਬੱਚੇ ਨੂੰ ਆਪਣੇ ਪੰਜਾਬ ਦੇ ਟਰਡੀਸ਼ਨ ਬਾਰੇ ਵੀ ਪਤਾ ਲੱਗੇਗਾ ਅਤੇ ਆਪਣੇ ਕਲਚਰ ਅਤੇ ਟਰਡੀਸ਼ਨ ਦੇ ਬਾਰੇ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ ਇਸ ਤਰ੍ਹਾਂ ਅਸੀਂ ਆਪਣੇ ਟਰਡੀਸ਼ਨ ਨੂੰ ਆਉਣ ਵਾਲੀ ਪੀੜ੍ਹੀਆਂ ਤੱਕ ਪ੍ਰਮੋਟ ਕਰ ਸਕਦੇ ਹਾਂ ਜਿਵੇਂ ਕਿ ਜ਼ਿਆਦਾਤਰ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਡਰੋਇੰਗ ਸਿਖਾਈ ਜਾਂਦੀ ਹੈ ਡਰੋਇੰਗ ਦੇ ਨਾਲ ਨਾਲ ਹੀ ਅਗਰ ਮਿੱਟੀ ਦੀਆਂ ਚੀਜ਼ਾਂ ਬਣਾਉਣੀਆਂ ਜਾਂ ਫਿਰ ਇੱਦਾਂ ਦੇ ਛੋਟੇ ਮੋਟੇ ਕਲਾ ਜੋ ਹੈ ਉਹ ਸਿਖਾਈ ਜਾਵੇ ਤਾਂ ਬੱਚੇ ਦਾ ਇੰਟਰਸਟ ਵੀ ਬਣੇਗਾ ਬ੍ਰੇਨ ਡਵੈਲਪਮੈਂਟ ਦੇ ਵਿੱਚ ਵੀ ਇਹ ਚੀਜ਼ਾਂ ਜੋ ਨੇ ਇਹ ਬਹੁਤ ਵਾਧਾ ਕਰਦੀਆਂ ਨੇ ਅਤੇ ਇੱਦਾਂ ਦੀਆਂ ਚੀਜ਼ਾਂ ਜੋ ਨੇ ਇਹ ਕਰੇਕੁਲਮ ਦੇ ਵਿੱਚ ਇੰਨਕਲੂਡਿਡ ਹੋਣੀਆਂ ਚਾਹੀਦੀਆਂ ਨੇ ਜਿਸ ਨਾਲ ਬੱਚਿਆਂ ਦਾ ਜੋ ਹੈ ਉਹ ਸਕਿੱਲਸ ਹੋਰ ਜ਼ਿਆਦਾ ਇਮਪਰੂਵ ਹੋਣ ਸਿਰਫ ਕਿਤਾਬੀ ਨੌਲੇਜ ਤੋਂ ਇਲਾਵਾ ਕਿਤਾਬੀ ਨੌਲੇਜ ਤੋਂ ਵੱਧ ਕੇ ਵੀ ਬੱਚਾ ਕੁਛ ਸਿੱਖੇ ਆਪਣੇ ਕਲਚਰ ਬਾਰੇ ਅਤੇ ਆਪਣੇ ਟਰਡੀਸ਼ਨ ਬਾਰੇ ਸਿੱਖੇ ਅਤੇ ਉਸਨੂੰ ਅੱਗੇ ਪ੍ਰਮੋਟ ਵੀ ਕਰੇ